ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਲਾ ਦੀ ਬਹੁਤ ਮਹੱਤਤਾ ਹੈ ਕਿਉਂਕਿ ਆਪਾਂ ਕੋਈ ਵੀ ਕੰਮ ਕਰਦੇ ਹਾਂ ਕੋਈ ਵੀ ਆਪਣੇ ਦੇ ਵਿੱਚ ਅੰਦਰ ਕੋਈ ਕਲਾ ਹੁੰਦੀ ਹੈ ਕਿਸੇ 'ਚ ਬੁਣਨ ਦੀ ਕਲਾ ਹੁੰਦੀ ਹੈ ਕਿਸੇ 'ਚ ਸਿਲਾਈ ਦੀ ਕਲਾ ਹੁੰਦੀ ਹੈ ਕਿਸੇ 'ਚ ਪੇਂਟਿੰਗ ਦੀ ਕਲਾ ਹੁੰਦੀ ਹੈ ਗਾਉਣ ਦੀ ਕਲਾ ਹੁੰਦੀ ਹੈ ਸਾਰੀ ਇੱਕ ਕਲਾ ਹੀ ਹੁੰਦੀ ਹੈ ਇਹ ਜੇ ਬੰਦ ਕੋਈ ਵੀ ਬੰਦਾ ਹੈਗਾ ਆਪਣੇ ਅੰਦਰ ਦੀ ਕਲਾ ਨੂੰ ਪਛਾਣ ਸਕਦਾ ਆ ਜੇ ਪਛਾਣ ਲਵੇ ਟਾਈਮ ਨਾਲ ਉਹ ਬਹੁਤ ਹੀ ਉੱਚੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ ਆ ਕਿਉਂਕਿ ਕਲਾ ਹੀ ਹੁੰਦੀ ਆ ਜਿਹਨੂੰ ਆਪਾਂ ਆਪਣੇ ਦਿਲ ਤੋਂ ਮਨ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਉਹ ਤਰੀਕੇ ਨਾਲ ਵਧੀਆ ਤਰੀਕੇ ਨਾਲ ਆਪਾਂ ਕੰਮ ਕਰ ਸਕਦੇ ਹਾਂ